ਇਸ ਖੇਤਰ ਵਿੱਚ ਬਹੁਤ ਸਾਰੀਆਂ ਧਾਰਮਿਕ ਪਰੰਪਰਾਵਾਂ ਹਨ ਅਸੀਂ ਸਿੱਖ ਧਰਮ ਨੂੰ ਮੰਨਦੇ ਹਾਂ ਜਿਸ ਵਿੱਚ ਗੁਰਬਾਣੀ ਦਾ ਵਿਚਾਰ ਕੀ ਪ੍ਰਚਾਰ ਕੀਤਾ ਜਾਂਦਾ ਹੈ ਮੈਂ ਹਫ਼ਤੇ ਵਿੱਚ ਦੋ ਵਾਰੀ ਸਤਿਸੰਗ ਘਰ ਜਾਂਦੀ ਹਾਂ ਸਤਿਸੰਗ ਘਰ ਜਾ ਕੇ ਵਿਛਾਈ ਦੀ ਸੇਵਾ ਕਰਦੇ ਹੈ ਝਾੜੂ ਦੀ ਸੇਵਾ ਕਰਦਾ ਹਾਂ ਅਤੇ ਲੰਗਰ ਦੀ ਸੇਵਾ ਕਰਦੇ ਹਾਂ ਅਤੇ ਉਸ ਵਿੱ ਤੋਂ ਬਾਅਦ ਸਤਿਸੰਗ ਹੁੰਦਾ ਹੈ ਸਤਿਸੰਗ ਸੁਣਦੇ ਹਾਂ ਸਤਿਸੰਗ ਵਿੱਚ ਗੁਰੂ ਦਸਾਂ ਗੁਰੂਆਂ ਦੀ ਬਾਣੀ ਦਾ ਪ੍ਰਚਾਰ ਹੁੰਦਾ ਹੈ ਅਤੇ ਸਾਨੂੰ ਬਹੁਤ ਵਧੀਆ ਸਿੱਖਿਆ ਮਿਲਦੀ ਹੈ ਅਤੇ ਸਾਨੂੰ ਸੈਕਟਰੀ ਸਾਹਿਬ ਨੇ ਅਨਾਊਸਮੈਂਟ ਕੀਤੀ ਕਿ ਐਤਵਾਰ ਨੂੰ ਬਿਆਸ ਸੇਵਾ ਜਾਣੀ ਹੈ ਅਤੇ ਅਸੀਂ ਚਾਰ ਪੰਜ ਸਹੇਲੀਆਂ ਨੇ ਇਕੱਠੇ ਹੋ ਕੇ ਸਲਾਹ ਕੀਤੀ ਕਿ ਆਪਾਂ ਨੂੰ ਕਾਫ਼ੀ ਟਾਈਮ ਹੋ ਗਿਆ ਹੈ ਬਿਆਸ ਗਿਆ ਨੂੰ ਆਪਾਂ ਨੇ ਬਿਆਸ ਸੇਵਾ ਲਈ ਜਾਣਾ ਹੈ ਅਤੇ ਅਸੀਂ ਚਾਰ ਪੰਜ ਸਹੇਲੀਆਂ ਨੇ ਸਲਾਹ ਕਰਕੇ ਸੇਵਾ ਵਿੱਚ ਨਾਮ ਲਿਖਵਾ ਦਿੱਤਾ ਅਤੇ ਫਿਰ ਅਸੀਂ ਐਤਵਾਰ ਨੂੰ ਸਤਿਸੰਗ ਘਰ ਅੱਠ ਵਜੇ ਪਹੁੰਚ ਗਏ ਅਤੇ ਸਾਢੇ ਅੱਠ ਵਜੇ ਸਾਡੀ ਬੱਸ ਉੱਥੋਂ ਚੱਲ ਪਈ ਅਤੇ ਸਾਡੀ ਬੱਸ ਰਸਤੇ ਵਿੱਚ ਬੰਗਾ ਸੈਂਟਰ ਵਿੱਚ ਰੁਕੀ ਉੱਥੇ ਸਾਨੂੰ ਚਾਹ ਪਾਣੀ ਪਿਲਾਇਆ ਅਤੇ ਫਿਰ ਬੱਸ ਅੱਗੇ ਚੱਲ ਪਈ ਅਤੇ ਰਸਤੇ ਵਿੱਚ ਅਸੀਂ ਸ਼ਬਦ ਵੀ ਬੋਲੇ ਸਾਰੀਆਂ ਭੈਣਾਂ ਨੇ ਰਲ਼ ਕੇ ਅਤੇ ਉਸ ਤੋਂ ਬਾਅਦ ਅਸੀਂ ਬਿਆਸ ਪਹੁੰਚ ਗਏ ਬਿਆਸ ਪਹੁੰਚ ਕੇ ਸਾਨੂੰ ਲੰਗਰ ਸੇਵਾ ਵਿੱਚ ਭੇਜ ਦਿੱਤਾ ਗਿਆ ਅਤੇ ਉੱਥੇ ਅਸੀਂ ਸਵੇਰੇ ਚਾਰ ਵਜੇ ਉੱਠ ਕੇ ਲੰਗਰ ਸੇਵਾ ਲਈ ਜਾਂਦੇ ਸੀ ਅਤੇ ਉੱਥੇ ਪਰਸ਼ਾਦੇ ਬਣਾਉਂਦੇ ਸੀ ਅਤੇ ਉਸ ਤੋਂ ਬਾਅਦ ਸਾਨੂੰ ਸਤਿਸੰਗ ਲਈ ਭੇਜ ਦਿੰਦੇ ਸੀ ਅਤੇ ਬਾਬਾ ਜੀ ਦਾ ਸਤਿਸੰਗ ਸੁਣ ਕੇ ਅਸੀਂ ਫੇਰ ਸੇਵਾ 'ਤੇ ਆ ਜਾਂਦੇ ਸੀਗੇ ਅਤੇ ਚਾਰ ਪੰਜ ਦਿਨ ਦੀ ਸੇਵਾ ਕਰਕੇ ਅਸੀਂ ਬਿਆਸ ਤੋਂ ਪੰਜਵੇਂ ਦਿਨ ਘਰ ਵਾਪਸ ਆ ਗਏ